ਹੈਲੋ ਤੁਸੀਂ ਅਮਨ ਗੱਲ ਕਰ ਰਹੇ ਹੋ ਹਾਂਜੀ ਮੈਨੂੰ ਤੁਹਾਡਾ ਨੰਬਰ ਸਰਬਜੀਤ ਦੀਦੀ ਨੇ ਦਿੱਤਾ ਸੀ ਹਾਂਜੀ ਐਕਚੁਲੀ ਮੈਂ ਨਾ ਹਾਂਜੀ ਮੋਹਾਲੀ 'ਚ ਨਵੀਂ ਆਈ ਹਾਂ ਹਾਂਜੀ ਹਾਂਜੀ ਹਾਂਜੀ ਅਤੇ ਦਰਅਸਲ ਮੈਨੂੰ ਇਹ ਨਹੀਂ ਪਤਾ ਕਿ ਇੱਥੇ ਨਾ ਜਿਹੜੀ ਤਾਜ਼ੀਆਂ ਸਬਜ਼ੀਆਂ ਏ ਆਪਣੇ ਨੇੜੇ ਕਿੱਥੋਂ ਮਿਲਦੀਆਂ ਨੇ ਮੈਨੂੰ ਦੋ ਤਿੰਨ ਵਾਰ ਜਿਹੜੇ ਮਤਲਬ ਜਿੱਥੋਂ ਵੀ ਮੈਂ ਲਈ ਆ ਨਾ ਉਹ ਸਬਜ਼ੀਆਂ ਤਾਜੀਆਂ ਨਹੀਂ ਲੱਗੀਆਂ ਅਤੇ ਉਹ ਜਦੋਂ ਉਹਨੂੰ ਪਕਾਇਆ ਉਹ ਮਤਲਬ ਬਹੁਤ ਜਿੱਦਾਂ ਸਵਾਦਿਸ਼ਟ ਵੀ ਨਹੀਂ ਬਣੀਆਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਹਾਂਜੀ ਮੈਨੂੰ ਉੱਥੇ ਜਾਣ ਦਾ ਰਸਤਾ ਦੱਸ ਸਕਦੇ ਹੋ ਕਿੱਥੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਮੰਡੀ ਮੰਡੀ ਦੀ ਜਿਹੜੀ ਉਹ ਹੈ ਜ਼ਿਆਦਾ ਦੂਰ ਤਾਂ ਨਹੀਂ ਹਾਂਜੀ ਹਾਂਜੀ ਚਲੋ ਤੁਸੀਂ ਫਿਰ ਚੱਲਿਓ ਜਾਂ ਫਿਰ ਤੁਸੀਂ ਮੈਨੂੰ ਦੱਸ ਦਿਓ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਚਲੋ ਆਪਾਂ ਕੱਲ੍ਹ ਸਵੇਰੇ ਦੇਖਾਂਗੇ ਫਿਰ ਕੱਲ੍ਹ ਸਵੇਰੇ ਚੱਲਾਂਗੇ ਸਵੇਰੇ ਦੇ ਟਾਈਮ ਸਬਜ਼ੀਆਂ ਜ਼ਿਆਦਾ ਤਾਜ਼ੀਆਂ ਹੁੰਦੀਆਂ ਨਾ ਫ਼ਿਰ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਧੰਨਵਾਦ